ਹੈਲੋ ਹਾਂਜੀ ਕੀ ਨਾਮ ਸਟੇਸ਼ਨਰੀ ਬੁੱਕ ਸ਼ੋਪ ਤੋਂ ਬੋਲ ਰਹੇ ਹੋ ਹਾਂਜੀ ਮੈਂ ਨਾ ਕੁਛ ਸਮਾਨ ਮੰਗਵਾਉਣਾ ਸੀ ਸਟੇਸ਼ਨਰੀ ਤੋਂ ਰਿਲੇਟਡ ਹਾਂਜੀ ਦੱਸੋ ਮੈਨੂੰ ਤੁਹਾਡੀ ਦੁਕਾਨ 'ਤੇ ਕਿਵੇਂ ਮਤਲਬ ਜੇ ਆਪਾਂ ਬੁੱਕਸ ਕੋਪੀਜ ਵਗੈਰਾ ਲੈਣੀਆਂ ਹੋਵੇ ਬੱਚੇ ਵਾਸਤੇ ਤਾਂ ਏ ਫੋਰ ਸ਼ੀ ਏ ਅੱਛਾ ਏ ਫੋਰ ਜਿਵੇਂ ਰਜਿਸਟਰ ਲੈਣੇ ਆ ਅਸੀਂ ਅਤੇ ਫੇਰ ਨੋਟਬੁੱਕ ਬਣਾਉਣ ਵਾਸਤੇ ਬੱਚਿਆਂ ਲਈ ਅੱਛਾ ਅਤੇ ਕੀ ਨਾਮ ਹੋਰ ਕੀ ਨਾਮ ਜਿਵੇਂ ਪੈਨਸਿਲ ਵਗੈਰਾ ਆਪਾਂ ਇਕੱਠੇ ਲੈਣੇ ਹੈ ਮੰਨ ਲਓ ਪੈਨਸਿਲ ਬੋਕਸ ਤਾਂ ਕਿਵੇਂ ਡਿਸਕਾਊਂਟ ਵਗੈਰਾ ਅੱਛਾ ਜੀ ਠੀਕ ਹੈ ਅਤੇ ਕੀ ਨਾਮ ਸਕੈਚ ਵੀ ਲੈਣੇ ਅਸੀਂ ਅੱਛਾ ਜੀ ਹਾਂਜੀ ਠੀਕ ਹੈ ਫੇਰ ਤੁਸੀਂ ਕੀ ਨਾਮ ਓਡਰ ਲਿਖ ਲਓ ਹਾਂਜੀ ਤੁਸੀਂ ਕੀ ਨਾਮ ਪੰਦਰ੍ਹਾਂ ਕੋਪੀਆਂ ਲਿਖ ਲਓ ਕੋਪੀਜ ਲਿਖ ਲ ਕਲਾਸਮੇਟ ਦੀਆਂ ਅਤੇ ਏ ਫੋਰ ਰਜਿਸਟਰ ਲਿਖ ਲਓ ਹੋਰ ਕੀ ਕੀ ਮਤਲਬ ਪੈਨਸਿਲ ਬੋਕਸ ਲਿਖ ਲਓ ਪੰਜ ਹਾਂਜੀ ਅਤੇ ਹੋਰ ਮਤਲਬ ਸਕੈਚ ਲਿਖ ਲਓ ਦੋ ਪੈਕਿਟ ਇੱਕ ਤਾਂ ਕਰਿਓਨਜ਼ ਅਤੇ ਇੱਕ ਵੋਟਰ ਸਕੈਚ ਜਿਹੜੇ ਹੁੰਦੇ ਆ ਅਤੇ ਹਾਂਜੀ ਅਤੇ ਅੱਛਾ ਨਹੀਂ ਉਹ ਤਾਂ ਚਲੋ ਜੀ ਨਹੀਂ ਉਹ ਤਾਂ ਹਾਂ ਹਾਂ ਅੱਛਾ ਨਹੀਂ ਕੀ ਨਾਮ ਕੋਪੀਜ ਕਵਰ ਕਰਨ ਵਾਸਤੇ ਤੁਸੀਂ ਕਵਰ ਵੀ ਦੇ ਦਿਆ ਜੇ ਜਿੰਨੀ ਕੋਪੀ ਲੈ ਰਹੇ ਹਾਂ ਅਸੀਂ ਓਨੇ ਨਾਲ ਕਵਰ ਦੇ ਦਿਆ ਜੇ ਹਾਂਜੀ ਅਤੇ ਕੀ ਨਾਮ ਸਾਰਾ ਸਮਾਨ ਮਤਲਬ ਤੁਸੀਂ ਪੈਕ ਵਗੈਰਾ ਕਰਕੇ ਅੱਛੀ ਤਰ੍ਹਾਂ ਹਾਂਜੀ ਅਤੇ ਮੈਂ ਤੁਹਾਨੂੰ ਮਤਲਬ ਐਡਰੈਸ ਸੈਂਡ ਕਰ ਦਾਂਗੀ ਅਤੇ ਤੁਸੀਂ ਦੇ ਦਿਆ ਜੇ ਹਾਂਜੀ ਹੋਮ ਡਿਲਵਰੀ ਹੈ ਨਾ ਤੁਹਾਡੇ ਕੋਲ ਓਪਸ਼ਨ ਜਾਂ ਅਸੀਂ ਲੈਣ ਆਈਏ ਹਾਂਜੀ ਠੀਕ ਹੈ ਮੈਂ ਐਡਰੈਸ ਵੀ ਸੈਂਡ ਕਰ ਦੂੰਗੀ ਤੁਹਾਨੂੰ ਅਤੇ ਹਮ ਬਸ ਵਧੀਆ ਕੁਆਲਟੀ ਦੀ ਦੇਣੀ ਹੈ ਕੋਪੀਜ ਵਗੈਰਾ ਸਭ ਪੈਨਸਿਲ ਵਗੈਰਾ ਵਧੀਆ ਕੁਆਲਟੀ ਦੀ ਦਿਆ ਜੇ ਹਾਂਜੀ ਅਤੇ ਪੇਮੈਂਟ ਤੁਸੀਂ ਕਿਵੇਂ ਲੈਂਦੇ ਹੋ ਔਨ ਮਤਲਬ ਕੈਸ਼ 'ਚ ਜਾਂ ਔਨਲਾਈਨ ਪੇਮੈਂਟ ਮੋਡ ਵੀ ਹੈਗਾ ਕੁਛ ਅੱਛਾ ਜੀ ਚਲੋ ਠੀਕ ਹੈ ਫਿਰ ਹਾਂ ਬਸ ਚੀਜ਼ਾਂ ਸਾਰੀ ਵਧੀਆ ਕੁਆਲਟੀ ਦੀ ਦੇਣੀਆਂ ਨੇ ਠੀਕ ਹੈ ਜੀ